ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰੇ ਜੀਵਨ ਨੂੰ ਸਿਲਾਈ ਨੇ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਨੂੰ ਅ ਛੋਟੇ ਹੁੰਦੀਆਂ ਤੋਂ ਹੀ ਸਿਲਾਈ ਸਿੱਖਣ ਦਾ ਬਹੁਤ ਸ਼ੌਂਕ ਸੀ ਅਤੇ ਮੈਂ ਚਾਹੁੰਦੀ ਸਾਂ ਕਿ ਮੈਂ ਆਪਣੇ ਪੈਰਾਂ 'ਤੇ ਖ਼ੁਦ ਸਟੈਂਡ ਹੋ ਸਕਾਂ ਮੈਂ ਚਾਹੁੰਦੀ ਸਾਂ ਕਿ ਮੈਂ ਖ਼ੁਦ ਸਿਲਾਈ ਕਰ ਸਕਾਂ ਮੈਨੂੰ ਸ਼ੁਰੂ ਤੋਂ ਹੀ ਸਿਲਾਈ ਦਾ ਬਹੁਤ ਸ਼ੋਂਕ ਸੀ ਇਸ ਲਈ ਮੈਂ ਬਚਪਨ ਵਿੱਚ ਵੀ ਆਪਣੇ ਮਨ ਵਿੱਚ ਸਿਲਾਈ ਦਾ ਸ਼ੌਂਕ ਪੈਦਾ ਕੀਤਾ ਸੀ ਜਦੋਂ ਮੈਂ ਵੱਡੀ ਹੋਈ ਤਾਂ ਮੈਂ ਸਿਲਾਈ ਸਿੱਖਣੀ ਸ਼ੁਰੂ ਕਰ ਦਿੱਤੀ ਜਦੋਂ ਕਿ ਪਹਿਲੇ ਤਾਂ ਮੈਨੂੰ ਤਰਪਾਈ ਵੀ ਕਰਨੀ ਨਹੀਂ ਸੀ ਆਉਂਦੀ ਮੈਂ ਇੱਕ ਬਟਨ ਵੀ ਨਹੀਂ ਸੀ ਲਗਾ ਸਕਦੀ ਫਿਰ ਮੈਂ ਹੌਲੀ ਹੌਲੀ ਮੈਨੂੰ ਮੇਰੀ ਮੰਮੀ ਨੇ ਸਿਲਾਈ 'ਤੇ ਪਾ ਦਿੱਤਾ ਜੋ ਕਿ ਸਾਡੇ ਘਰ ਦੇ ਕੋਲ ਇੱਕ ਬੁਟੀਕ ਸੀ ਅਤੇ ਮੇਰੀ ਮੰਮੀ ਨੇ ਮੈਨੂੰ ਸਿਲਾਈ 'ਤੇ ਭੇਜਣਾ ਸ਼ੁਰੂ ਕਰ ਦਿੱਤਾ ਮੈਂ ਸਿਲਾਈ 'ਤੇ ਜਾ ਕੇ ਪਹਿਲਾਂ ਤਾਂ ਛੋਟੇ ਕੱਪੜੇ ਸਿਉਣੇ ਸਿੱਖੇ ਫਿਰ ਮੈਂ ਵੱਡੇ ਕੱਪੜੇ ਸਿਉਣੇ ਸਿੱਖੇ ਅੱਜ ਮੈਂ ਇੱਕ ਸੂਟ ਵੀ ਬਣਾ ਲੈਂਦੀ ਹਾਂ ਅਤੇ ਮੈਨੂੰ ਆਪਣੇ 'ਤੇ ਮਾਣ ਹੈ ਜਦੋਂ ਕਿ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਮੈਂ ਆਪਣੀ ਖ਼ੁਦ ਦੇ ਪੈਸਿਆਂ ਦੀ ਚੀਜ਼ ਲੈ ਆਉਂਦੀ ਹਾਂ ਮੈਨੂੰ ਸਿਲਾਈ ਸਿੱਖਣ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਈ ਮੈਂ ਹਰ ਵਕਤ ਆਪਣੇ ਆਪ ਨੂੰ ਬਹੁਤ ਹੀ ਮਾਣ ਅਤੇ ਗਰਵ ਮਹਿਸੂਸ ਕਰਦੀ ਹਾਂ ਮੈਂ ਸਿਲਾਈ ਸਿੱਖਣ ਵਿੱਚ ਕਿਸੇ ਵੀ ਚੀਜ਼ ਦੀ ਰੁਕਾਵਟ ਨਹੀਂ ਆਉਣ ਦਿੱਤੀ ਮੈਂ ਅੱਜ ਵੀ ਮੈਂ ਨੇ ਮੇਰਾ ਹੁਣ ਵਿਆਹ ਹੋ ਚੁੱਕਾ ਹੈ ਅਤੇ ਮੇਰੇ ਘਰ ਵਾਲੇ ਨੇ ਵੈਸੇ ਕਦੀ ਵੀ ਮੈਨੂੰ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਆਉਣ ਦਿੱਤੀ ਪਰ ਫਿਰ ਵੀ ਮੈਂ ਆਪਣੇ ਕੰਮ ਨੂੰ ਕਦੀ ਵੀ ਪਿੱਛੇ ਨਹੀਂ ਪੈਣ ਦਿੱਤਾ ਮੈਂ ਆਪਣਾ ਕੰਮ ਬੜੀ ਖੁਸ਼ੀ ਨਾਲ ਕਰਦੀ ਹਾਂ ਅਤੇ ਮੈਂ ਜਿਹਨਾਂ ਕੋਲ ਸਿਲਾਈ ਸਿੱਖਦੀ ਹਾਂ ਅਤੇ ਅੱਜ ਮੈਂ ਉਨ੍ਹਾਂ ਦੀ ਬੁਟੀਕ 'ਤੇ ਹੀ ਕੰਮ ਕਰਦੀ ਹਾਂ ਜਦੋਂ ਕਿ ਪਹਿਲਾਂ ਆਉਣ ਤੋਂ ਉਨ੍ਹਾਂ ਕੋਲੋਂ ਮੈਂ ਕੰਮ ਸਿੱਖਦੀ ਹਾਂ ਅਤੇ ਅੱਜ ਉਹ ਮੇਰੇ ਕੋਲੋਂ ਖ਼ੁਦ ਆਪਣਾ ਕੰਮ ਕਰਵਾਉਂਦੇ ਨੇ ਅਤੇ ਮੈਨੂੰ ਕੰਮ ਕਰਨ ਵਿੱਚ ਬਹੁਤ ਖ਼ੁਸ਼ੀ ਮਿਲਦੀ ਹੈ ਅਤੇ ਮੈਂ ਆਪਣੇ ਪਤੀ ਨੂੰ ਵੀ ਆਪਣੇ ਕੰਮ ਕਰਨ ਦੇ ਵਿੱਚ ਉਤਸ਼ਾਹਿਤ ਕਰਦੀ ਹਾਂ ਅਤੇ ਉਹ ਵੀ ਖੁਸ਼ ਹੁੰਦੇ ਹਨ ਮੇਰਾ ਕੰਮ ਵੇਖ ਕੇ ਅਤੇ ਜਦੋਂ ਕਿ ਮੈਨੂੰ ਆਪਣਾ ਕੰਮ ਕਰਨ 'ਤੇ ਮਾਣ ਹੈ ਮੈਂ ਅ ਘਰ ਦੇ ਕੰਮ ਵਿੱਚ ਕਈ ਵਾਰੀ ਥੱਕ ਜਾਂਦੀ ਹਾਂ ਅਤੇ ਕਦੀ ਕਦੀ ਮੇਰਾ ਲੱਕ ਦਰਦ ਹੋਣ ਲੱਗ ਪੈਂਦਾ ਹੈ ਜਦੋਂ ਕਿ ਮੈਨੂੰ ਫਿਰ ਵੀ ਮੈਂ ਕਦੀ ਵੀ ਇਸ ਕੰਮ ਤੋਂ ਨਹੀਂ ਭੱਜਦੀ ਮੈਨੂੰ ਸਿਲਾਈ ਸਿੱਖਣਾ ਅਤੇ ਕਰਨਾ ਬਹੁਤ ਹੀ ਵਧੀਆ ਲੱਗਿਆ ਮੈਨੂੰ ਆਪਣਾ ਸਿਲਾਈ ਸਿੱਖਣ 'ਤੇ ਮਾਣ ਹੈ ਧੰਨਵਾਦ